ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਇੱਥੋਂ ਸਾਡੀ ਬੱਸ ਦੇ ਸਾਰੇ ਪਾਸੇ ਕਨੈਕਸ਼ਨ ਨੇ ਅਸੀਂ ਹਿਮਾਚਲ ਜਲੰਧਰ ਚੰਡੀਗੜ੍ਹ ਅਤੇ ਫਿਰੋਜ਼ਪੁਰ ਫਾਜ਼ਿਲਕਾ ਹਰ ਪਾਸੇ ਸਾਡੀ ਬੱਸ ਜਾਂਦੀ ਹੈ ਅਤੇ ਸਾਡੀ ਬੱਸ ਦੇ ਏ ਸੀ ਲੱਗੇ ਹੋਏ ਨੇ ਅਤੇ ਮੰਨੋਰੰਜਨ ਲਈ ਟੀ ਵੀ ਵੀ ਲੱਗੇ ਹੋਏ ਨੇ ਅਤੇ ਸੀਟਾਂ ਵੀ ਸਾਰੀਆਂ ਆਰਾਮਦਾਇਕ ਨੇ ਹਾਂਜੀ ਅਤੇ ਤੁਸੀਂ ਜਦੋਂ ਅਤੇ ਤੁਸੀਂ ਜਦੋਂ ਵੀ ਆਉਣਾ ਹੋਵੇ ਤੁਸੀਂ ਦੱਸ ਦਿਓ ਕਿੰਨੇ ਟਾਈਮ 'ਤੇ ਆਉਣਾ ਵਾ ਤਾਂ ਤੁਹਾਨੂੰ ਇੱਕ ਨੰਬਰ ਸੈਂਡ ਕਰ ਦਿੰਦੇ ਹਾਂ ਉਹਦੇ 'ਤੇ ਤੁਸੀਂ ਸੰਪਰਕ ਕਰ ਲਿਓ ਸਾਡੇ ਨਾਲ ਹਾਂਜੀ ਵਾਪਸ ਜਾਣ ਦਾ ਵੀ ਤੁਹਾਨੂੰ ਸਾਡੀਆਂ ਬੱਸਾਂ ਦਾ ਉਹ ਵੀ ਟਾਈਮ ਹੈਗਾ ਵਾ ਅਤੇ ਤੁਸੀਂ ਜਦੋਂ ਵੀ ਵਾਪਸ ਜਾਣਾ ਹੋਵੇ ਉਦੋਂ ਤੁਸੀਂ ਸੰਪਰਕ ਕਰ ਲਿਓ ਸਾਡੇ ਨਾਲ ਅਤੇ ਅਸੀਂ ਤੁਹਾਨੂੰ ਸਮਾਂ ਦੱਸਦਾਂਗੇ ਵਾਪਸੀ ਦਾ ਹਾਂਜੀ